ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਜੁੱਤੀ ਦੇਖਣੀ ਜੀ ਵਿਆਹ 'ਚ ਪਾਉਣ ਵਾਸਤੇ ਜੀ ਮੈਨੂੰ ਛੇ ਨੰਬਰ ਚਾਹੀਦਾ ਜੀ ਅਸੀਂ ਪੰਜਾਬੀ ਜੁੱਤੀ ਦੇਖਣੀ ਆ ਪੰਜਾਬੀ ਦਿਖਾਓ ਨਾ ਪਹਿਲਾਂ ਅੱਛਾ ਜੀ ਅੱਛਾ ਜੀ ਠੀਕ ਆ ਜੀ ਅਸੀਂ ਇੱਕ ਵਾਰ ਪੰਜਾਬੀ ਜੁੱਤੀ ਦਿਖਾ ਦਿਓ ਸਾਨੂੰ ਆਹ ਆਹ ਵਾਲੀ ਦਿਖਾ ਦਿਓ ਜੀ ਛੇ ਨੰਬਰ ਹਾਂਜੀ ਹੁਣ ਉਹ ਰੰਗ ਦਿਖਾ ਦਿਓ ਕਿਹੜੇ ਕਿਹੜੇ ਕਿਹੜੇ ਕਿਹੜੇ ਰੰਗ ਤੁਹਾਡੇ ਕੋਲ ਇੱਕ ਆ ਛੇ ਨੰਬਰ ਲਾਹੋ ਹਾਂਜੀ ਠੀਕ ਹੈ ਜੀ

ਇੱਕ ਵਾਰੀ ਹੀਲ ਵਾਲੀ ਵੀ ਦਿਖਾਓਗੇ ਨਾ ਜਿਹੜੀ ਮੇਰੀ ਜੁੱਤੀ ਹਾਂਜੀ ਨਹੀਂ ਜੀ ਫਿਰ ਨਾ ਉਹ ਵੀ ਵੇਖ ਲੈਂਦੇ ਹਾਂ ਜੀ ਜਿਹੜੀ ਸਾਨੂੰ ਪਸੰਦ ਲੱਗੇਗੀ ਪੰਜਾਬੀ ਸਾਈਡ 'ਤੇ ਕਰ ਦਿਓ ਨਾ ਪੰਜਾਬੀ ਜੁੱਤੀ ਸਾਈਡ 'ਤੇ ਕਰ ਦਿਓ ਨਾ ਇੱਕ ਨਾ ਹਾਂਜੀ ਹਾਂਜੀ ਹਾਂਜੀ ਸਾਈਡ 'ਤੇ ਕਰ ਦਿਓ ਜੀ ਰੰਗ ਕੋਈ ਨਾ ਆਪਾਂ ਕਰ ਲਾਂਗੇ ਤੁਸੀਂ ਇੱਕ ਸਾਈਡ 'ਤੇ ਕਰ ਦਿਓ ਨਾ ਫਿਰ ਆਪਾਂ ਜਿਹੜੀ ਮੈਨੂੰ ਜਚੇਗੀ ਮੈਂ ਲੈ ਲਵਾਂਗੇ ਰੰਗ ਮੇਰੇ ਕੋਲ ਹੀ ਪਏ ਨੇ ਸਾਰੇ ਹਾਂਜੀ ਹਾਂਜੀ ਇਹ ਵੀ ਸਹੀ ਸਹੀ ਆਉਂਦਾ ਮੈਨੂੰ ਚਾਹੇ ਇਹ ਹੀਲ ਵਾਲੀ ਹੈ ਹੀਲ ਜ਼ਿਆਦੀ ਆ ਜੀ ਮੈਨੂੰ ਹੀਲ ਘੱਟ ਵਾਲੀ ਦਿਖਾਉਣਾ ਐਂਉਂ ਕਰੋ ਨਾ ਤੁਸੀਂ ਮੈਨੂੰ ਹੀਲ ਤੋਂ ਘੱਟ ਦਿਖਾ ਦਿਓ ਨਾ ਅਤੇ ਪਤਾ ਕੀ ਆ ਹੀਲ ਘੱਟ ਵਾਲੀ ਮਿਲ ਜਾਂਦੀ ਤਾਂ ਠੀਕ ਸੀ ਵਧੀਆ ਜੀ ਚਲ ਇੱਕ ਪੰਜਾਬੀ ਉਹਦੇ 'ਚ ਆਪਾਂ ਵੇਖ ਲੈਂਦੇ ਅਤੇ ਹੀਲ ਤੋਂ ਮਾੜੀ ਜਿਹੀ ਮੈਂ ਘੱਟ ਵੇਖ ਲੈਂਦੀ ਠੀਕ ਹੈ ਨਾ ਚਲੋ ਐਂਉਂ ਕਰੋ ਤੁਸੀਂ ਸਾਈਡ 'ਤੇ ਕਰੋ ਛੋਟੇ ਬੱਚਿਆਂ ਦੀ ਸਲਿੱਪਰ ਦਿਖਾ ਦੇਣਾ ਹਾਂਜੀ ਹਾਂਜੀ ਇਹ ਮਤਲਬ ਇੱਕ ਤਾਂ ਪੰਜਾਬੀ ਕਰ ਦੇਈਏ ਜਿਹੜੇ ਤੁਸੀਂ ਹੀਲ ਵਾਲੀ ਦਿਖਾਈ ਇਹ ਵੀ ਸਾਈਡ 'ਤੇ ਇਸ ਤਰ੍ਹਾਂ ਕਰ ਦਿਓ ਬੱਚਿਆਂ ਜਿਵੇਂ ਦਿਖਾ ਦਿਓ ਤਿੰਨ ਨੰਬਰ ਹਾਂਜੀ ਨਹੀਂ ਨਹੀਂ ਅਸੀਂ ਪਿੱਪਲ ਦੇ ਮਤਲਬ ਘਰੇ ਪਾਉਣ ਲਈ ਬੱਚੇ ਵਾਸਤੇ ਵੀ ਦੇਖਣੀ ਆ ਨਹੀਂ ਜੀ ਗੁੜੀਆ ਲਈ ਦਿਖਾ ਦਿਓ ਜੀ ਹਾਂਜੀ ਹਾਂਜੀ ਬੂਟ ਨਹੀਂ ਨਹੀਂ ਨਹੀਂ ਕੱਪੜੇ ਦੇ ਬੂਟ ਨਹੀਂ ਚੱਪਲ ਮੈਂ ਤੈਨੂੰ ਆਖਿਆ ਹਾਂਜੀ ਅੱਛਾ ਚੱਪਲ ਵੀ ਚੱਪਲ ਮੇਰੇ ਪਸੰਦ ਨਹੀਂ ਆਈ ਚੱਪਲ ਮੇਰੇ ਪਸੰਦ ਨਹੀਂ ਆਈ ਹਾਂਜੀ ਅੱਛਾ ਮਾਲ ਕੱਲ੍ਹ ਆਏਗਾ ਹਾਂਜੀ ਫਿਰ ਤੁਸੀਂ ਮੰਗਵਾ ਦੇਣਾ ਹੈ ਹਾਂਜੀ ਮੇਰੇ ਨਾ ਪਸੰਦ ਨਹੀਂ ਲੱਗੀ ਇਹਨਾਂ ਜੁਤੀਆਂ ਦਾ ਰੇਟ ਕੀ ਜੀ ਦੱਸ ਦਿਓ ਮੈਨੂੰ ਅੱਛਾ ਹਜ਼ਾਰ ਦੀ ਪੰਜਾਬੀ ਜੁੱਤੀ ਅਤੇ ਜਿਹੜੀ ਆਪਾਂ ਹੀਲ ਵਾਲੀ ਦੇਖੀ ਆ ਅੱਛਾ ਪੰਜ ਸੌ ਲਾ ਲਓਗੇ ਫੇਰ ਹੈਂ ਚਲੋ ਪੈਕ ਕਰ ਦਿਓ ਹਾਂਜੀ ਚਲੋ ਠੀਕ ਹੈ ਪੈਕ ਕਰ ਦਿਓ ਹਾਂਜੀ ਠੀਕ ਹੈ ਹਾਂਜੀ ਧੰਨ ਹਾਂਜੀ ਧੰਨਵਾਦ ਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਧੰਨਵਾਦ ਧੰਨਵਾਦ